ਕੋਈ ਵੀ ਇੱਕ ਬਿਜਨਸ ਹੁੰਦਾ ਹੈ ਤਾਂ ਉਸ ਵਿੱਚ ਇਨਵੈਸਟਮੈਂਟ ਕਾਫ਼ੀ ਜ਼ਰੂਰੀ ਐਸੈਂਸ਼ਅਲ ਪਾਰਟ ਹੁੰਦਾ ਹੈ ਇੱਕ ਵੱਡੀ ਇਨਵੈਸਟਮੈਂਟ ਤੋਂ ਮੇਰਾ ਮੰਨਣਾ ਇਹ ਹੈ ਕਿ ਜਿੰਨੀ ਵੱਡੀ ਇਨਵੈਸਟਮੈਂਟ ਹੋਵੇਗੀ ਉੰਨਾ ਜ਼ਿਆਦਾ ਹੀ ਸਾਨੂੰ ਲਾਭ ਹੋਵੇਗਾ ਇੱਕ ਬਿਜ਼ਨਸ ਸਟਾਰਟ ਕਰਨ ਲਈ ਪੂੰਜੀ ਦਾ ਜ਼ਿਆਦਾ ਹੋਣਾ ਕਾਫ਼ੀ ਨਸੈਸਰੀ ਹੈ ਕਿਉਂਕਿ ਜੇਕਰ ਜ਼ਿਆਦਾ ਪੁੰਜੀ ਹੋਵੇਗੀ ਤਾਂ ਅਸੀਂ ਉਸ ਲੈਵਲ ਦਾ ਮਤਲਬ ਮਸ਼ੀਨਰੀ ਲੈ ਸਕਦੇ ਹਨ ਅਤੇ ਪਲਸ ਲੇਬਰ ਰੱਖ ਸਕਦੇ ਹਨ ਅਤੇ ਸਾਡੀ ਕੰਪਨੀ ਦਾ ਇਨਫਰਾਸਟਰਕਚਰ ਸਭ ਕੁਝ ਵਧੀਆ ਹੋਵੇਗਾ ਅਤੇ ਆਪਾਂ ਇੱਕ ਜੇ ਜੇ ਵਧੀਆ ਪੂੰਜੀ ਹੋਵੇਗੀ ਤਾਂ ਇਹ ਅਸੀਂ ਵਧੀਆ ਵਧੀਆ ਸਕਿੱਲਡ ਵਰਕਰ ਨੂੰ ਹਾਇਰ ਕਰੂੰਗੇ ਜਿਸ ਕਰਕੇ ਸਾਡੀ ਕੰਪਨੀ ਦੀ ਇੱਕ ਆਊਟਪੁੱਟ ਵਧੀਆ ਆਵੇਗੀ ਅਤੇ ਸਾਡਾ ਪ੍ਰੋਫਿਟ ਜ਼ਿਆਦਾ ਆਵੇਗਾ ਇਸ ਕਰਕੇ ਮੇਰਾ ਮੰਨਣਾ ਤਾਂ ਇਹ ਹੀ ਹੈ ਕਿ ਇੱਕ ਕੰਪਨੀ ਖੋਲ੍ਹਣ ਲਈ ਇੱਕ ਵਧੀਆ ਇਨਵੈਸਟਮੈਂਟ ਦਾ ਹੋਣਾ ਕਾਫ਼ੀ ਲਾਜ਼ਮੀ ਹੈ